ਪੰਜ ਸੌ ਨੌ ਨੌ ਸੌ ਨੜਿਨਵੇਂ ਅੱਠ ਹਜ਼ਾਰ ਤਿੰਨ ਸੌ ਪੈਂਤੀ ਵੀਹ ਹਜ਼ਾਰ ਛੇ ਸੌ ਬਾਈ ਇੱਕ ਲੱਖ ਦੋ ਹਜ਼ਾਰ ਚਾਰ ਸੌ ਸੱਠ